ਬਾਕੀ ਰਾਜਾਂ ਦਾ ਤਾਂ ਮੈਨੂੰ ਪਤਾ ਨਹੀਂ ਲੇਕਿਨ ਪੰਜਾਬ ਵਿੱਚ ਦੋ ਪ੍ਰੰਪਰਾਗਤ ਖੇਡਾਂ ਹੈਗੀਆਂ ਜਿੱਦਾਂ ਪਹਿਲੀ ਕੁਸ਼ਤੀ ਅਤੇ ਦੂਜੀ ਕਬੱਡੀ ਅਤੇ ਇਹ ਕੱਬਡੀ ਅਤੇ ਜੋ ਕਿ ਕੁਸ਼ਤੀ ਹੈ ਕਾਫ਼ੀ ਵੇਖੀ ਜਾਂਦੀ ਹੈ ਆਪਣੇ ਪੰਜਾਬ ਵਾਲੀ ਸਾਈਡ ਅਤੇ ਗੱਲ ਕੀਤੀ ਜਾਵੇ ਤਾਂ ਪਾਕਿਸਤਾਨ ਪੰਜਾਬ 'ਚ ਵੀ ਕਾਫ਼ੀ ਖੇਡੀ ਜਾਂਦੀਆਂ ਇਹ ਚੀਜ਼ਾਂ ਅਤੇ ਸਾਡ ਜੇਕਰ ਪਠਾਨਕੋਟ ਦੀ ਗੱਲ ਕੀਤੀ ਜਾਵੇ ਤਾਂ ਕਾਫ਼ੀ ਖੇਡ ਮੇਲੇ ਕੁਸ਼ਤੀ ਛਿੰਝ ਮੇਲੇ ਲੱਗਦੇ ਆ ਅਤੇ ਇੱਥੇ ਜਿਹੜੇ ਬੱਚੇ ਆਉਂਦੇ ਹੈ ਮੇਰੇ ਵਰਗੇ ਉਨ੍ਹਾਂ ਨੂੰ ਕਾਫ਼ੀ ਪ੍ਰੇਰਨਾ ਮਿਲਦੀ ਹੈ ਆਪਣੀ ਮਿੱਟੀ ਨਾਲ ਜੁੜੇ ਰਹਿਣ ਦੀ ਅਤੇ ਕਾਫ਼ੀ ਵਧੀਆ ਲੱਗਦਾ ਹੈ ਕਿ ਲੋਕ ਨਸ਼ਿਆਂ ਤੋਂ ਦੂਰ ਹੋ ਕੇ ਆਪਣੀ ਸਿਹਤ ਵੱਲ ਧਿਆਨ ਦਿੰਦੇ ਹੈ ਅਤੇ ਇਹ ਚੀਜ ਇੱਕ ਪ੍ਰੇਰਨਾ ਦਾ ਸਰੋਤ ਆ ਉਹਨਾਂ ਬੱਚਿਆਂ ਲਈ ਜੋ ਕਿ ਨਸ਼ਿਆਂ ਵਿੱਚ ਲੱਗ ਗਏ ਨੇ ਅਤੇ ਇਹ ਕਾਫ਼ੀ ਵੱਡੀ ਚੀਜ਼ ਹੈ ਜੋ ਕਿ ਉਹ ਕਰ ਰਹੇ ਨੇ ਕੁਸ਼ਤੀ ਅਤੇ ਕਬੱਡੀ ਦੇ ਖਿਡਾਰੀ ਅਤੇ ਜੇਕਰ ਗੱਲ ਕੀਤੀ ਜਾਵੇ ਤਾਂ ਸਮਾਗਮ ਹੁੰਦੇ ਆ ਹਾਂਜੀ ਕਾਫ਼ੀ ਸਮਾਗਮ ਹੁੰਦੇ ਆ ਇੱਥੇ ਤਾਂ ਕਾਫ਼ੀ ਵੱਡੇ ਇਨਾਮ ਵੀ ਦਿੱਤੇ ਜਾਂਦੇ ਹੈ ਜਿਵੇਂ ਕਿ ਟ੍ਰੈਕਟਰ ਹੋ ਗਿਆ ਮੋਟਰ ਸਾਈਕਲ ਹੋ ਗਿਆ ਇਕਵੰਜਾ ਹਜ਼ਾਰ ਹੋ ਗਿਆ ਅਤੇ ਇਹ ਚੀਜ਼ ਕਾਫ਼ੀ ਪ੍ਰੇਰਿਤ ਕਰਦੀ ਹੈ ਲੋਕਾਂ ਨੂੰ ਕੁਸ਼ਤੀ ਅਤੇ ਕਬੱਡੀ ਖੇਡਣ ਵਿੱਚ